ਹੈਲੋ ਨਾਗਪਾਲ ਕੌਸਮੈਟਿਕਸ ਤੋਂ ਬੋਲਦੇ ਹੋ ਮੈਂ ਤੁਹਾਡੇ ਤੋਂ ਇੱਕ ਕਰੀਮ ਆਡਰ ਕੀਤੀ ਸੀ ਹਿਮਾਲਿਆ ਕਰੀਮ ਜੀ ਉਹ ਕਰੀਮ ਬਹੁਤ ਹੀ ਜ਼ਿਆਦਾ ਗੰਦੀ ਆਈ ਐ ਮੇਰਾ ਸਾਰਾ ਸਾਰਾ ਫੇਸ ਖਰਾਬ ਹੋ ਚੁੱਕਿਆ ਉਹਦੇ ਉੱਤੇ ਮੇਰੇ ਫੇਸ ਉੱਤੇ ਬਹੁਤ ਸਾਰੇ ਪਿੰਪਲ ਵੀ ਹੋ ਚੁੱਕੇ ਨੇ ਮੈਂ ਤਾਂ ਤੁਹਾਡੇ ਬਾਰੇ ਬਹੁਤ ਜਿਆਦਾ ਸੁਣਿਆ ਸੀ ਕੀ ਤੁਹਾਡੀ ਦੁਕਾਨ ਕਾਫੀ ਵਧੀਆ ਜਾਂ ਤਾਂ ਤੁਸੀਂ ਮੇਰੀ ਹੁਣ ਕਰੀਮ ਲੈ ਲਓ ਜਾਂ ਮੇਰੇ ਪੈਸੇ ਵਾਪਸ ਮੋੜੋ ਇੱਕ ਤਾਂ ਮੈਂ ਇਨਾ ਖਰਚਾ ਕੀਤਾ ਕਰੀਮ ਉੱਤੇ ਉੱਤੋਂ ਕਰੀਮ ਕਿਸੇ ਕੰਮ ਦੀ ਨੀ ਨਿਕਲੀ ਇੰਨੀ ਗੰਦੀ ਕੋਸਮੈਟਿਕਸ ਤੁਸੀਂ ਵੇਚਦੇ ਹੋ ਮੈਂ ਤਾਂ ਬੜਾ ਸੁਣਿਆ ਸੀਗਾ ਇੱਕ ਤਾਂ ਕਰੀਮ ਉੱਤੇ ਇੰਨੇ ਸਾਰੇ ਉਹ ਦਿੱਤੇ ਹੁੰਦੇ ਆ ਵੀ ਬਹੁਤ ਵਧੀਆ ਕਰੀਮ ਕਿਸੇ ਕੰਮ ਦੀ ਕਰੀਮ ਨਹੀਂ ਹੈਗੀ ਇੰਨੀ ਗੰਦੀ ਕਰੀਮ ਤੁਸੀਂ ਵੇਚਦੇ ਹੋ ਮੈਂ ਹੁਣ ਅੱਗੇ ਤੋਂ ਕਦੇ ਵੀ ਤੁਹਾਡੀ ਦੁਕਾਨ ਤੋਂ ਕਰੀਮ ਨਹੀਂ ਲਊਗੀ ਆਪਦੇ ਦੋਸਤਾਂ ਨੂੰ ਵੀ ਦੱਸੂਗੀ ਤੁਹਾਡੇ ਤੇ ਕੋਈ ਵੀ ਚੀਜ਼ ਨਾ ਲੈਣ ਮੈਨੂੰ ਮੇਰੇ ਪੈਸੇ ਜਲਦੀ ਤੋਂ ਜਲਦੀ ਵਾਪਸ ਚਾਹੀਦੇ ਨੇ ਜਾਂ ਤਾਂ ਤੁਸੀਂ ਮੇਰੀ ਪਲੀਜ਼ ਕਰੀਮ ਵਾਪਸ ਲਓ ਨਹੀਂ ਤਾਂ ਮੈਂ ਕੀ ਕਹਿੰਦੇ ਸਾਰਿਆਂ ਨੂੰ ਕਵਾਂਗੀ ਕੀ ਤੁਹਾਡੀ ਦੁਕਾਨ ਤੋਂ ਕੁਛ ਵੀ ਨਾ ਲੈਣ ਕਿਉਂਕਿ ਤੁਹਾਡੇ ਪ੍ਰੋਡਕਟਸ ਬਹੁਤ ਹੀ ਗੰਦੇ ਹੁੰਦੇ ਨੇ ਇਹਦੇ ਨਾਲ ਬਹੁਤ ਹੀ ਨੈਗੇਟਿਵ ਇਫੈਕਟ ਪੈ ਰਿਹਾ ਕਿਉਂਕਿ ਮੇਰਾ ਸਾਰਾ ਦਾ ਸਾਰਾ ਫੇਸ ਖਰਾਬ ਹੋ ਜਾਏਗਾ ਸਾਰਾ ਪਿੰਪਲ ਹੋ ਚੁੱਕਿਆ ਸਭ ਕੁਛ ਤਾਂ ਇਸ ਲਈ ਹੁਣ ਪਲੀਜ਼ ਮੇਰਾ ਜਾਂ ਤਾਂ ਪੈਸੇ ਉਹ ਕਰੋ ਜਾਂ ਫਿਰ ਤੁਸੀਂ ਆਪਣਾ ਦੇਖ ਲਓ